ਭੰਗੜੇ ਵਿੱਚ ਮੁੰਡੇ ਧੋਤੀ ਕੁੜਤਾ ਪਾਉਂਦੇ ਹਨ ਕੁੜੀਆਂ ਉੱਚੇ ਜੈਂਪਰ ਅਤੇ ਪਟਿਆਲਾ ਸਲਵਾਰਾਂ ਪਾਉਂਦੀਆਂ ਹਨ ਮੁੰਡੇ ਸਿਰ ਉੱਤੇ ਪੱਗੜੀਆਂ ਬੰਨ੍ਹਦੇ ਹਨ ਕੁੜੀਆਂ ਭਾਰੇ ਭਾਰੇ ਦੁਪੱਟੇ ਕਰਦੀਆਂ ਹਨ ਦੁਪੱਟੇ ਉੱਤੇ ਗੋਟਾ ਲਗਾਉਂਦੀਆਂ ਹਨ ਪੰ ਪੰਜਾਬੀਆਂ ਦੇ ਪਹਿਰਾਵੇ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਪੰਜਾਬ ਦੇ ਲੋਕ ਹਨ ਭੰਗੜੇ ਦਾ ਪਹਿਰਾਵਾ ਪੰਜਾਬੀਆਂ ਦੀ ਸ਼ਾਨ ਵਧਾਉਂਦਾ ਹੈ ਪਹਿਰਾਵੇ ਨਾਲ ਭੰਗੜੇ ਦੇ ਸਟੈੱਪ ਵਧੀਆ ਤਰ੍ਹਾਂ ਦਿਖਦੇ ਹਨ ਜੋ ਲੋਕਾਂ ਨੂੰ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ